ਵੈਸੇ ਤਾਂ ਬਹੁਤ ਸਾਰੀਆਂ ਸਥਾਨਕ ਖੇਡਾਂ ਅਤੇ ਮਨੋਰੰਜਨ ਗਤੀਵਿਧੀਆਂ ਹਨ ਜਿਹਨਾਂ ਨਾਲ ਜਿਹੜੇ ਹੈਗੇ ਹੋਸ਼ਿਆਰਪੁਰ ਜ਼ਿਲ੍ਹੇ ਦੇ ਜਿਹੜੇ ਹੈਗੇ ਹੈ ਲੋਕ ਜਿਹੜੇ ਹੈਗੇ ਹੈ ਇਕੱਠੇ ਹੁੰਦੇ ਹੈਗੇ ਹੈ ਅਤੇ ਦੁਨੀਆਂ ਭਰ ਵਿੱਚ ਪ੍ਰਸਿੱਧ ਹੈਗੀਆਂ ਜਿੱਦਾਂ ਸਾਰਿਆਂ ਨਾਲੋਂ ਪਹਿਲਾਂ ਆਪਾਂ ਦੇਖਿਆ ਜਾ ਸਕਦਾ ਹੈਗਾ ਏ ਜਿਹੜੀ ਕਬੱਡੀ ਕਬੱਡੀ ਤਾਂ ਪੰਜਾਬ 'ਚ ਉਹ ਵੀ ਪੰਜਾਬ 'ਚ ਹੁਸ਼ਿਆਰਪੁਰ ਦੀ ਬਹੁਤ ਜ਼ਿਆਦਾ ਪ੍ਰਸਿੱਧ ਹੈਗੀ ਹੈ ਜਿੱਦਾਂ ਹੁਣ ਸਾਡਾ ਇੱਥੇ ਦਾ ਮੁੰਡਾ ਹੈਗਾ ਤਾਂ ਇੱਕ ਸੁਲਤਾਨ ਇੱਥੇ ਦਾ ਬਹੁਤ ਵਧੀਆ ਰੇਡਰ ਹੈਗਾ ਤਾਂ ਹੁਸ਼ਿਆਰਪੁਰ ਦਾ ਉਹ ਕਬੱਡੀ ਦਾ ਬੜਾ ਮੰਨਾ ਬੜਾ ਮੰਨਿਆ ਦੁੱਲਾ ਭੱਟੀ ਇਹ ਵੀ ਮ ਬੜੇ ਘੈਂਟ ਰੇਡਰ ਹੈਗੇ ਆ ਇਹ ਜਿਹੜੇ ਹੈਗੇ ਦੁਨੀਆਂ ਭਰ ਵਿੱਚ ਪ੍ਰਸਿੱਧ ਹੈਗੇ ਆ ਰੇਡਰ ਇਹ ਜਿਹੜੇ ਹੈਗੇ ਜਿੱਦਾਂ ਹੁਣ ਕੋਈ ਮੇਲੇ ਵਗੈਰਾ ਹੋ ਗਏ ਸਪੈਸ਼ਲੀ ਜਿੱਦਾਂ ਹੁਣ ਜਿੱਦਾਂ ਕਹਿੰਦੇ ਨਹੀਂ ਹੈਗੇ ਆ ਪੰਜਾਬੀਆਂ ਦਾ ਨੇਚਰ ਹੈਗਾ ਏ ਜਿਹੜੇ ਪੰਜਾਬੀ ਕਹਿੰਦੇ ਹੈਗੇ ਆ ਇਹ ਜ਼ਿਆਦਾਤਰ ਸਰੀਰਕ ਕੰਮ ਕਰਨ ਨੂੰ ਤਰਜੀਹ ਦਿੰਦੇ ਹੈਗੇ ਹੈ ਸਪੈਸਲੀ ਜਿਹੀ ਕਬੱਡੀ ਇਹ ਕਬੱਡੀ ਜਿਹੜੀ ਹੈਗੀ ਹੈ ਪੰਜਾਬ ਦੇ ਪੰਜਾਬ ਦੇ ਸੱਭਿਆਚਾਰ ਨੂੰ ਵੀ ਦਰਸਾਉਂਦੀ ਹੈਗੀ ਆ ਵੀ ਜਿੱਦਾਂ ਕਹਿੰਦੇ ਨਹੀਂ ਹੈਗੇ ਆ ਜਿਹਦੇ ਚ ਜ਼ੋਰ ਹੋਵੇਗਾ ਜਿਹਦੇ 'ਚ ਦਮ ਹੋਵੇਗਾ ਉਹ ਪੱਟ 'ਤੇ ਥਾਪੀ ਮਾਰ ਕੇ ਦੂਜੇ ਦੇ ਪਾਟੇ 'ਚ ਲੁੱਟ ਕਸੁੱਟ ਕਰਦਾ ਭਾਰ ਭਾਵ ਕਿ ਬਈ ਦੂਜੇ ਦੇ ਪਾਂਡੇ ਜਿਹੜੇ ਹੈਗੇ ਜਿਹੜੇ ਉਹਦੇ ਜਾਫੀ ਵਗੈਰਾ ਹੁੰਦੇ ਆ ਉਹਨਾਂ ਨੂੰ ਹੱਥ ਲਾ ਕੇ ਜਾਂ ਪੁਆਇੰਟ ਲਾ ਕੇ ਜਿਹੜਾ ਰੇਡਰ ਹੈਗਾ ਪੱਟ 'ਤੇ ਥਾਪੀ ਮਾਰਦਾ ਉਹਨਾਂ ਦੇ ਆ ਪਾਲੇ ਤੋਂ ਆਪਣੇ ਪਾਲੇ ਵੱਲ ਚਲਾ ਜਾਂਦਾ ਹੈਗਾ ਇਹ ਪੰਜਾਬੀਆਂ ਦੇ ਜਿਹੜੇ ਸੱਭਿਆਚਾਰ ਨੂੰ ਬਹੁਤ ਵਧੀਆ ਢੰਗ ਆ ਰੀਪ੍ਰਜੈਂਟ ਕਰਦੀ ਹੈਗੀ ਹੈ ਇਹਦੇ ਨਾਲ ਲੋਕਾਂ ਵਿੱਚ ਜਿੱਦਾਂ ਹੁਣ ਸਪੈਸ਼ਲੀ ਜਿਹੜਾ ਜਿੱਦਾਂ ਹੁਣ ਕਿਤੇ ਟੂਰਨਾਮੈਂਟ ਵਗੈਰਾ ਹੁੰਦਾ ਵੱਡੇ ਵੱਡੇ ਇਨਾਮ ਰੱਖੇ ਜਾਂਦੇ ਹੈਗੇ ਆ ਉੱਦਾਂ ਜਿੱਦਾਂ ਕਹਿੰਦੇ ਨਹੀਂ ਹੈਗੇ ਜਿਹੜਾ ਸਾਡਾ ਹੁਸ਼ਿਆਰਪੁਰ ਹੈਗਾ ਏ ਇਹ ਦੁਆਬੇ 'ਚ ਪੈਂਦਾ ਜਿਦਾਂ ਕਹਿੰਦੇ ਨਹੀਂ ਹੈਗੇ ਆ ਬਈ ਜਿਹੜਾ ਪੂਰੇ ਪੰਜਾਬ ਦੇ ਉਧਰ ਰੁਪਈਆ ਚੱਲਦਾ ਤਾਂ ਦੁਆਬੇ 'ਚ ਡਾਲਰ ਚਲਦਾ ਭਾਈ ਡਾਲਰ ਵਾਸਤੇ ਹੁਸ਼ਿਆਰਪੁਰ ਜ਼ਿਲ੍ਹਾ ਵੀ ਪੂਰਾ ਪ੍ਰਸਿੱਧ ਹੈਗਾ ਏ ਇਸ ਕਰਕੇ ਜਿਹੜੀ ਇੱਥੇ ਕਬੱਡੀ ਦੇ ਬੜੇ ਬੜੇ ਨਾਮ ਰੱਖੇ ਜਾਂਦੇ ਹੈਗੇ ਜਿੱਥੇ ਲੋਕ ਵੱਧ ਤੋਂ ਵੱਧ ਆਉਂਦੇ ਅਤੇ ਭਾਈਚਾਰੇ ਦੀ ਭਾਵਨਾ ਪੈਦਾ ਹੁੰਦੀ ਹੈਗੀ ਹੈ ਅਤੇ ਇੱਥੇ ਜਿਹੜੇ ਹੋਰ ਵੀ ਜਿਹੜੇ ਸਥਾਨਕ ਮੇਲੇ ਹੁੰਦੇ ਹੈਗੇ ਆ ਧਾਰਮਿਕ ਮੇਲੇ ਹੁੰਦੇ ਉੱਥੇ ਵੀ ਲੋਕ ਜਿਹੜੇ ਹੈਗੇ ਹੈ ਵੱਧ ਤੋਂ ਵੱਧ ਪੁੱਜਦੇ ਹੈਗੇ ਆ ਅਤੇ ਇੱਥੇ ਜਿਹੜਾ ਹੈਗਾ ਲੋਕਾਂ ਵਿੱਚ ਭਾਈਚਾਰੇ ਦੀ ਭਾਵਨਾ ਮਿਲ ਜੁਲ ਕੇ ਰਹਿਣਾ ਡਿਸਿਪਲਨ ਵਗੈਰਾ ਅਤੇ ਇਸ ਤੋਂ ਇਲਾਵਾ ਹੋਰ ਵੀ ਜਿਹੜੀਆ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਏ ਲੋਕਾਂ ਵਿੱਚ ਜਿਹੜੀਆਂ ਹੈਗੀਆਂ ਉਹ ਡਿਵੈਲਪ ਹੁੰਦੀਆਂ ਹੈਗੀਆਂ ਏ